ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਨੀ ਹੈ ਮੈ ਗੁਰਦਾਸਪੁਰ ਤੋਂ ਬੋਲਦੀ ਪਈ ਹਾਂ ਅਤੇ ਅੱਜ ਕੱਲ੍ਹ ਮੈਂ ਅੱਜ ਕੱਲ੍ਹ ਅੱਜ ਮੈਂ ਮਤਲਬ ਮੋਬਾਈਲ ਫੋਨ ਦੇ ਬਾਰੇ 'ਚ ਗੱਲ ਕਰਨਾ ਚਾਹੁੰਦੀ ਹਾਂ ਅੱਜ ਕੱਲ੍ਹ ਬੱਚੇ ਕੀ ਕਰਦੇ ਹੈਗੇ ਜ਼ਿਆਦਾ ਟਾਈਮ ਜਿਹੜਾ ਹੈਗਾ ਆਪਣੇ ਮਤਲਬ ਮੋਬਾਈਲ ਨੂੰ ਜ਼ਿਆਦਾ ਸਪੈਂਡ ਕਰਦੇ ਹਨ ਉਹ ਆਪਣੇ ਮੋਬਾਈਲ ਵਿਚ ਮਤਲਬ ਗੇਮਾਂ ਖੇਡਦੇ ਰਹਣ ਗੇ ਗੇਮਾਂ ਹੀ ਖੇਡਦੇ ਰਹਿੰਦੇ ਹਨ ਜੋ ਕਿ ਮਤਲਬ ਉਹਨਾਂ ਦੇ ਮਤਲਬ ਸਰੀਰਿਕ ਲਈ ਜੋ ਸਿਹਤ ਲਈ ਜੋ ਹੈ ਬਹੁਤ ਹਾਨੀਕਾਰਕ ਹੈ ਬੱਚਿਆਂ ਨੂੰ ਕੀ ਚਾਹੀਦਾ ਅੱਜ ਕੱਲ੍ਹ ਬੱਚਿਆਂ ਨੂੰ ਮਤਲਬ ਖੇਡਾਂ ਖੇਡਣੀਆਂ ਚਾਹੀਦੀਆਂ ਪਹਿਲੇ ਟਾਈਮ 'ਤੇ ਕੀ ਹੁੰਦਾ ਸੀ ਕਿ ਲੋਕ ਜਿਹੜੇ ਹੈ ਮਤਲਬ ਇਹ ਫੋਨ ਮਤਲਬ ਫੋਨ ਨਹੀਂ ਹੁੰਦੇ ਸੀ ਲੋਕ ਫੋਨਾਂ ਵੱਲ ਮਤਲਬ ਇੰਨਾ ਉਹਨਾਂ ਦਾ ਧਿਆਨ ਨਹੀਂ ਹੁੰਦਾ ਸੀ ਬੱਚੇ ਕੀ ਹੁੰਦੇ ਸੀ ਖੇਡਾਂ ਖੇਡਦੇ ਸੀ ਤਰ੍ਹਾਂ ਤਰ੍ਹਾਂ ਦੀਆਂ ਖੇਡਾਂ ਖੇਡਦੇ ਸੀ ਅਤੇ ਅੱਜ ਕੱਲ੍ਹ ਦੇ ਜਿਹੜੇ ਬੱਚੇ ਹੈ ਉਹ ਮੋਬਾਈਲ 'ਤੇ ਜ਼ਿਆਦਾ ਟਾਈਮ ਦਿੰਦੇ ਹਨ ਜਿਹਦੇ ਰਾਹੀਂ ਕਿ ਉਹ ਸਾਡੇ ਸਿਹਤ ਲਈ ਬਹੁਤ ਹਾਨੀਕਾਰਕ ਆ ਉਹਦੇ ਨਾਲ ਮਤਲਬ ਇੱਕ ਤਾਂ ਅੱਖਾਂ ਨੂੰ ਅਫੈਕਟ ਕਰਦੀ ਹੈ ਅੱਖਾਂ ਦੇ ਪ੍ਰਭਾਵ ਪੈਂਦਾ ਉਹਦੇ ਨਾਲ ਸਾਡੇ ਮਤਲਬ ਮਤਲਬ ਅੱਖਾਂ ਨੂੰ ਵੀ ਫੈਕਟ ਕਰਦੀ ਹੈ ਦੂਸਰਾ ਸਾਡਾ ਮਤਲਬ ਜਿਹੜਾ ਦਿਮਾਗ ਵੀ ਇਹਦੇ ਨਾਲ ਅ ਰੈਸਟ ਨਹੀਂ ਮਿਲ ਪਾਉਂਦੀ ਹੈਗੀ ਬੱਚੇ ਜੋ ਹੈ ਮਤਲਬ ਇੱਕ ਮਨੋਵਿਗਿਆਨਿਕ ਮਨੋਵਿਗਿਆਨ ਦਾ ਸ਼ਿਕਾਰ ਵੀ ਹੋ ਜਾਂਦੇ ਹਨ ਅਤੇ ਬੱਚਿਆਂ ਨੂੰ ਚਾਹੀਦਾ ਹੈ ਕਿ ਖੇਡਾਂ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਆ ਅਤੇ ਇਹਨਾਂ ਨੂੰ ਫੋਨ ਮਤਲਬ ਘੱਟ ਯੂਜ਼ ਕਰਨਾ ਚਾਹੀਦਾ ਹੈ ਧੰਨਵਾਦ